ਪੰਜਾਬੀ ਸਿੱਖਣ ਦੀ ਗੱਲ ਕਰੀਏ ਤਾਂ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਔਰ ਮਾਤ ਭਾਸ਼ਾ ਤਾਂ ਬੱਚੇ ਨੂੰ ਜਨਮ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਸਦੇ ਘਰ ਪਰਿਵਾਰ ਸਾਰੇ ਉਸ ਮਾਤ ਭਾਸ਼ਾ ਵਿੱਚ ਹੀ ਗੱਲ ਕਰਦੇ ਹਨ ਤਾਂ ਔਟੋਮੈਟਿਕਲੀ ਹੀ ਬੱਚੇ ਨੂੰ ਉਹ ਮਾਤ ਭਾਸ਼ਾ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਇਹ ਹੁੰਦੀ ਹੈ ਮੌਖਿਕ ਭਾਸ਼ਾ ਜਿਹੜੀ ਸਿਰਫ ਅਸੀਂ ਗੱਲਬਾਤ ਦੇ ਨਾਲ ਹੀ ਕਰ ਸਕਦੇ ਹਾਂ ਉਹ ਅਸੀਂ ਆਪਣੇ ਘਰ ਤੋਂ ਸ਼ੁਰੂ ਕਰਕੇ ਆਪਣੇ ਆਂਢ ਗੁਆਂਢ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਕੇ ਉਹ ਭਾਸ਼ਾ ਸਿੱਖਦੇ ਹਾਂ ਪਰ ਉਸ ਭਾਸ਼ਾ ਦਾ ਅਗਰ ਲਿਖਤੀ ਰੂਪ ਦੇਖੀਏ ਤਾਂ ਉਹ ਅਸੀਂ ਆਪਣੇ ਸਕੂਲ ਵਿੱਚ ਜਦੋਂ ਅਸੀਂ ਐਡਮਿਸ਼ਨ ਲੈਂਦੇ ਹਾਂ ਉੱਥੇ ਸਾਨੂੰ ਲਾਈਨ ਵਾਈਸ ਸਟੈਪ ਬਾਏ ਸਟੈਪ ਉਹ ਸਾਨੂੰ ਲਿਖਤੀ ਭਾਸ਼ਾ ਸਿਖਾਈ ਜਾਂਦੀ ਹੈ ਔਰ ਭਾਸ਼ਾ ਦਾ ਅਨੁਭਵ ਹੀ ਇਹ ਕਿ ਪੰਜਾਬੀ ਦੀ ਜਿਹੜੀ ਭਾਸ਼ਾ ਹੈ ਇਹ ਬਹੁਤ ਹੀ ਪਿਆਰੀ ਅਤੇ ਮਿੱਠੀ ਭਾਸ਼ਾ ਹੈ ਇਸ ਦੀ ਲਿਪੀ ਗੁਰਮੁਖੀ ਹੈ ਜੋ ਕਿ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸੀ ਮਾਤ ਭਾਸ਼ਾ ਹੋਣ ਦੇ ਨਾਲ ਨਾਲ ਇੱਕ ਬੜੀ ਮਿੱਠੀ ਭਾਸ਼ਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਲਿਪੀ ਹੈ ਉਹ ਵੀ ਗੁਰਮੁਖੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਅਗਰ ਸਮਝਣਾ ਹੈ ਪੜ੍ਹਨਾ ਹੈ ਅਨੁਭਵ ਕਰਨਾ ਹੈ ਤਾਂ ਸਾਨੂੰ ਗੁਰਮੁਖੀ ਆਉਣੀ ਬਹੁਤ ਜ਼ਰੂਰੀ ਹੈ ਪੰਜਾਬੀ ਭਾਸ਼ਾ ਆਉਣੀ ਬਹੁਤ ਜ਼ਰੂਰੀ ਹੈ ਮਾਤ ਭਾਸ਼ਾ ਦੇ ਨਾਲ ਇੱਕ ਇਨਸਾਨ ਦਾ ਅਸਤਿਤਵ ਜੁੜਿਆ ਹੁੰਦਾ ਹੈ ਮਾਤ ਭਾਸ਼ਾ ਦੇ ਵਿੱਚ ਇੱਕ ਇਨਸਾਨ ਜੋ ਕੰਫਰਟੇਬਲ ਫੀਲ ਕਰਦਾ ਹੈ ਉਹ ਦੂਸਰੀ ਭਾਸ਼ਾ ਦੇ ਵਿੱਚ ਨਹੀਂ ਕਰਦਾ ਪੰਜਾਬੀ ਭਾਸ਼ਾ ਸਾਡੀ ਜ਼ਿੰਦ ਹੈ ਸਾਡੇ ਪ੍ਰਾਣ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੱਸੀਏ ਤਾਂ ਇਹ ਸਭ ਦੇ ਸਾਂਝੇ ਗੁਰੂ ਹਨ ਸਾਰੇ ਸੰਸਾਰ ਦੇ ਸਭ ਧਰਮਾਂ ਦੇ ਸਾਂਝੇ ਗੁਰੂ ਹਨ ਇਹਨਾਂ ਨੂੰ ਸਮਝਣ ਲਈ ਤਾਂ ਸਾਨੂੰ ਗੁਰਮੁਖੀ ਆਉਣੀ ਚਾਹੀਦੀ ਹੈ ਇਸ ਲਈ ਮੇਰਾ ਖਿਆਲ ਹੈ ਕਿ ਸਭ ਨੂੰ ਪੰਜਾਬੀ ਭਾਸ਼ਾ ਸਿੱਖਣੀ ਚਾਹੀਦੀ ਹੈ ਔਰ ਆਪਣੀ ਜ਼ਿੰਦਗੀ ਵਿੱਚ ਅਪਣਾਉਣੀ ਚਾਹੀਦੀ ਹੈ ਕਿਉਂਕਿ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਗੱਲ ਦੁਬਾਰਾ ਕਰ ਰਹੇ ਹਾਂ ਅਗਰ ਅਸੀਂ ਇਹਨੂੰ ਇੰਗਲਿਸ਼ ਹਿੰਦੀ ਦੇ ਵਿੱਚ ਇਹਦੇ ਅਨੁਵਾਦ ਆ ਚੁੱਕੇ ਹਨ ਪਰ ਜੋ ਮਿਠਾਸ ਜੋ ਅਨੁਭਵ ਜੋ ਅਸੀਂ ਫੀਲ ਕਰਦੇ ਹਾਂ ਮਹਿਸੂਸ ਕਰਦੇ ਹਾਂ ਇੱਕ ਗੁਰੂ ਨੂੰ ਗੁਰੂ ਦੀ ਗੋਦ ਵਿੱਚ ਬੈਠਣਾ ਉਹ ਅਸੀਂ ਪੰਜਾਬੀ ਵਿੱਚ ਹੀ ਗੁਰਮੁਖੀ ਵਿੱਚ ਹੀ ਕਰ ਸਕਦੇ ਹਾਂ ਇਸ ਲਈ ਪੰਜਾਬੀ ਭਾਸ਼ਾ ਬਹੁਤ ਹੀ ਵਧੀਆ ਭਾਸ਼ਾ ਹੈ ਔਰ ਜਿਸ ਤਰ੍ਹਾਂ ਇੰਗਲਿਸ਼ ਨੂੰ ਇਨ ਇੰਟਰਨੈਸ਼ਨਲ ਲੈਂਗੁਏਜ ਮੰਨਿਆ ਗਿਆ ਇਸ ਤਰ੍ਹਾਂ ਕਮ ਸੇ ਕਮ ਪੰਜਾਬੀ ਨੂੰ ਵੀ ਬਾਕੀ ਸਟੇਟਸ ਵਿੱਚ ਵੀ ਬੁਲਾਉਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਇਹਦੀ ਗਹਿਰਾਈ ਇਹਦਾ ਅਪਣੱਤ ਇਹਦਾ ਮਿੱਠਾਪਨ ਫੀਲ ਹੋ ਸਕੇ ਔਰ ਉਸ ਪੰਜਾਬੀ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਸਕਣ ਕਿਉਂਕਿ ਇਸ ਭਾਸ਼ਾ ਦੀ ਵਰਗੀ ਕੋਈ ਹੋਰ ਭਾਸ਼ਾ ਨਹੀਂ ਹੈ